ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਵਧੀਆ ਹਾਂਜੀ ਬੱਚੇ ਠੀਕ ਨੇ ਆਈਲੈਟਸ ਦੀ ਤਿਆਰੀ ਕਰ ਰਹੇ ਬਾਹਰ ਜਾਣਾ ਕਹਿੰਦੇ ਹਾਂਜੀ ਹਾਂਜੀ ਹਾਂਜੀ ਕੁਛ ਨਹੀਂ ਬਸ ਮੈਂ ਤਾਂ ਘਰ ਹੁੰਦੀ ਸਲਾਈ ਸਲੁਈ ਕਰੀ ਜਾਈ ਦੀ ਹੈ ਹਾਂਜੀ ਬਾਹਰ ਜਾਣ ਦਾ ਬੜਾ ਭੂਤ ਸਵਾਰ ਹੋਇਆ ਹੋਇਆ ਬੱਚਿਆਂ 'ਤੇ ਸਾਰੇ ਬਾਹਰ ਹਾਂਜੀ ਬਾਹਰ ਜਾ ਕੇ ਕੰਮ ਕਰਨਗੇ ਕਹਿੰਦੇ ਬਾਹਰ ਜਾਣਾ ਏ ਅਸੀਂ ਕਿਹਾ ਚੱਲ ਜਾਓ ਭਾਈ ਕਿਆ ਪਤਾ ਦੇਖਣਗੇ ਹਾਂਜੀ ਹਾਂਜੀ ਉਧਰ ਸਾਰੇ ਕੰਮ ਕਰਨੇ ਮਨਜ਼ੂਰ ਨੇ ਹਾਂ ਉਧਰ ਸਾਰੇ ਕੰਮ ਕਰਨੇ ਮਨਜ਼ੂਰ ਹੈ ਪਰ ਇੱਥੇ ਨਹੀਂ ਕਰਨੇ ਹਾਂਜੀ ਹਾਂਜੀ ਤੁਹਾਡੀ ਕਾਲ ਹੋਲਡ ਕੀਤੀ ਗਈ ਹੈ ਕਿਰਪਾ ਕਰਕੇ ਲਾਈਨ 'ਤੇ ਬਣੇ ਰਵੋ ਆਪਕਾ ਕੋਲ ਹੋਲਡ ਪਰ ਹੈ ਲਾਈਨ ਪਰ ਬਨੇ ਰਹੇਂ ਯਾ ਕੁਛ ਦੇਰ ਬਾਅਦ ਕੋਸ਼ਿਸ਼ ਕਰੇਂ ਹੈਲੋ ਮੈਂ ਕਿਹਾ ਤੁਹਾਡੇ ਬੇਟੇ ਕੀ ਕਰ ਰਹੇ ਅੱਜ ਕੱਲ੍ਹ ਅੱਛਾ ਆਹ ਸਾਡੇ ਗਵਾਂਢੀਆਂ ਦਾ ਮੁੰਡਾ ਵੀ ਸਾਡੇ ਗਵਾਂਢੀਆਂ ਦਾ ਮੁੰਡਾ ਵੀ ਗਿਆ ਹਜੇ ਥੋੜ੍ਹੇ ਦਿਨ ਹੋਏ ਆ ਸਾਡੇ ਰਿਸ਼ਤੇਦਾਰੀ 'ਚੋਂ ਬਹੂ ਗਈ ਹੈ ਸਾਡੀ ਸਾਡੇ ਕਈ ਰਿਸ਼ਤੇਦਾਰ ਬਾਹਰ ਹੀ ਰਹਿੰਦੇ ਆ ਹਾਂਜੀ ਉਹੀ ਤਾਂ ਹੈ ਤੁਹਾਡੀ ਕੋਲ ਹੋਲਡ ਕੀਤੀ ਗਈ ਹੈ ਕਿਰਪਾ ਕਰਕੇ ਲਾਈਨ 'ਤੇ ਬਣੇ ਰਵੋ ਹੈਲੋ ਤੁਹਾਡੀ ਕੋਲ